ਸਾਡੇ ਇਲਾਕੇ ਵਿੱਚ ਐਮ ਸੀ ਦੀ ਵੋਟਾਂ ਲੜ ਰਹੇ ਹਨ ਇੱਕ ਐਮ ਸੀ ਜਿਨਾਂ ਦਾ ਨਾਮ ਰੋਮੀ ਹੈ ਉਹ ਸਾਡੇ ਇਲਾਕੇ ਦੀਆਂ ਸਮੱਸਿਆਵਾਂ ਦੂਰ ਕਰਨ ਦਾ ਵਾਅਦਾ ਕਰਦੇ ਹਨ ਉਹਨਾਂ ਦਾ ਏਜੰਡਾ ਹੈ ਉਹਨਾਂ ਦੇ ਪ੍ਰੋਸ ਆਪਣੇ ਪ੍ਰੋਸਪੈਕਟਸ ਵਿੱਚ ਦੱਸਿਆ ਗਿਆ ਹੈ ਅਗਰ ਜੇਕਰ ਤੁਸੀਂ ਮੈਨੂੰ ਪੂਰਨ ਬਹੁਮਤ ਦੇ ਕੇ ਜਿਤਾ ਦਿੰਦੇ ਹੋ ਤਾਂ ਮੈਂ ਤੁਹਾਡੇ ਹਰ ਮੁਹੱਲੇ ਦੀ ਹਰੇਕ ਗਲੀ ਵਿੱਚ ਡਸਟਬਿਨ ਦਾ ਪ੍ਰਬੰਧ ਕਰ ਦੇਵਾਂਗਾ ਅਤੇ ਹਰ ਉਹ ਗਲੀ ਨੂੰ ਬਣਾਵਾਂਗਾ ਜਿਹੜੀ ਕਿ ਟੁੱਟੀ ਫੁੱਟੀ ਹੋਈ ਹੈ ਅਤੇ ਡਰੈਨੇਜ਼ ਸਿਸਟਮ ਚੰਗੀ ਤਰ੍ਹਾਂ ਸਹੀ ਕਰਵਾ ਦੇਵਾਂਗਾ ਅਤੇ ਕਿਸੇ ਨੂੰ ਵੀ ਕਿਸੇ ਵੀ ਤਰ੍ਹਾਂ ਦੇ ਅਗਰ ਸਾਈਨ ਚਾਹੀਦੇ ਹੋਣ ਤਾਂ ਇਹ ਤੁਹਾਡਾ ਐਮ ਸੀ ਤੁਹਾਡੀ ਖਾਤਿਰਦਾਰੀ ਵਿੱਚ ਹਰ ਸਮੇਂ ਮੌਜੂਦ ਰਹੇਗਾ ਕਿਉਂਕਿ ਐਮ ਸੀ ਦਾ ਕੰਮ ਹੀ ਹੁੰਦਾ ਹੈ ਸਾਡੀ ਸੇਵਾ ਕਰਨਾ ਜਾਨੀ ਕਿ ਆਮ ਜਨਤਾ ਦੀ ਸੇਵਾ ਕਰਨਾ ਇਸ ਤਰ੍ਹਾਂ ਹੀ ਸਰਕਾਰਾਂ ਵਿੱਚ ਸ਼ਾਮਿਲ ਹੁੰਦੇ ਨੇ ਹਨ ਐਮ ਸੀ ਜਿਨ੍ਹਾਂ ਤੋਂ ਉੱਤੇ ਹੁੰਦੇ ਹਨ ਐਮ ਐਲ ਏ ਅਤੇ ਉਸ ਤੋਂ ਉੱਤੇ ਸੀ ਐਮ ਉਸ ਉੱਤੇ ਪੀ ਐਮ ਇਹਨਾਂ ਨੂੰ ਸਾਰਿਆਂ ਨੂੰ ਅਸੀਂ ਹੀ ਫੰਡ ਕਰਦੇ ਹਾਂ ਜਿਸ ਪ੍ਰਕਾਰ ਕੋਈ ਵੀ ਨਾਗਰਿਕ ਸਰਕਾਰੀ ਨੌਕਰੀ ਕਰਦਾ ਹੈ ਤਾਂ ਉਹਨਾਂ ਦੀ ਤਨਖਾਹ ਵਿੱਚੋਂ ਤੀਹ ਪ੍ਰਸੈਂਟ ਟੈਕਸ ਜਾਂਦਾ ਹੈ ਜੋ ਕਿ ਕੰਸੋਲੀਡੇਟ ਫੰਡ ਵਿੱਚ ਜਾਂਦਾ ਹੈ ਅਤੇ ਬਾਅਦ ਵਿੱਚ ਇਹਨਾਂ ਨੂੰ ਤਨਖਾਹਾਂ ਮਿਲਦੀਆਂ ਹਨ ਅਤੇ ਇਹ ਜਿਹੜਾ ਪੈਸਾ ਹੁੰਦਾ ਹੈ ਉਹ ਹੀ ਪੈਸੇ ਨਾਲ ਇਹ ਭਾਰਤ ਦਾ ਵਿਕਾਸ ਕਰਦੇ ਹਨ ਅਤੇ ਸੜਕਾਂ ਬਣਾਉਂਦੇ ਹਨ ਅਤੇ ਆਮ ਜਨਤਾ ਜਾਨੀ ਆਪਣੇ ਵਾਸਤੇ ਯੋਜਨਾਵਾਂ ਲੈ ਕੇ ਆਉਂਦੇ ਹਨ ਜਿਨਾਂ ਕਰਕੇ ਸਾਡਾ ਦੇਸ਼ ਤਰੱਕੀ ਦੀ ਰਾਹ 'ਤੇ ਚੱਲਦਾ ਹੈ ਪਰ ਕਈ ਰਾਜਨੀਤਿਕ ਪਾਰਟੀਆਂ ਪੈਸਿਆਂ ਦਾ ਦੁਰ ਉਪਯੋਗ ਕਰਦੀਆਂ ਹਨ ਅਤੇ ਪੈਸਿਆਂ ਨੂੰ ਆਪਣੇ ਖਾਤੇ ਵਿੱਚ ਭਰ ਲੈਂਦੀਆਂ ਹਨ ਜੋ ਕਿ ਬਹੁਤ ਹੀ ਗਲਤ ਗੱਲ ਹੈ ਆਮ ਜਨਤਾ ਦੇ ਪੈਸਿਆਂ ਨੂੰ ਖਾਣ ਦਾ ਮਤਲਬ ਇੱਕ ਤਰ੍ਹਾਂ ਦੀ ਬਦ ਦੁਆ ਲੈਣੀ ਹੁੰਦੀ ਹੈ ਰਾਜਨੀਤੀਕ ਪਾਰਟੀਆਂ ਨੂੰ ਇਵੇਂ ਨਹੀਂ ਕਰਨਾ ਚਾਹੀਦਾ ਉਹਨਾਂ ਦੇ ਪੈਸੇ ਬਹੁਤ ਹੀ ਮਿਹਨਤ ਨਾਲ ਕਮਾਏ ਹੁੰਦੇ ਹਨ ਉਹਨਾਂ ਨੇ ਉਹ ਕੋਈ ਪੇੜ 'ਤੇ ਨਹੀਂ ਉੱਗਦੇ ਇਸ ਕਰਕੇ ਰਾਜਨੀਤਿਕ ਪਾਰਟੀਆਂ ਨੂੰ ਧਿਆਨ ਦੇਣਾ ਚਾਹੀਦਾ ਹੈ ਕਿ ਜਿਹੜੇ ਸਾਡੇ ਪੈਸੇ ਹਨ ਉਹ ਉਹਨਾਂ ਨੂੰ ਉਹ ਸਮਾਜ ਸੇਵਾ ਕਹਿ ਸਕਦੇ ਹਾਂ ਸਮਾਜ ਸੇਵਾ ਜਾਂ ਲੋਕਾਂ ਦੀ ਭਲਾਈ ਜਾਂ ਲੋਕਾਂ ਦੀ ਜ਼ਿੰਦਗੀ ਵਾਸਤੇ ਵਰਤਿਆ ਜਾਵੇ ਜਿਵੇਂ ਕਿ ਸਰਕਾਰੀ ਹਸਪਤਾਲ ਬਣਾਉਣਾ ਸਰਕਾਰੀ ਸਕੂਲ ਬਣਾਉਣਾ ਸਰਕਾਰੀ ਕਾਲਜ ਜਾਂ ਹੋਰ ਵੀ ਤਰ੍ਹਾਂ ਦੀ ਕੋਈ ਸਕੂਲਾਂ ਕਾਲਜਾਂ ਅਤੇ ਹਸਪਤਾਲਾਂ ਦੀ ਰਪੇਰਿੰਗ ਸੜਕਾਂ ਦੀ ਰਪੇਰਿੰਗ ਡਰੇਨੇਜ਼ ਸਿਸਟਮ ਨੂੰ ਸਹੀ ਕਰਨਾ ਜਾਂ ਜਿਸ ਵੀ ਪ੍ਰਕਾਰ ਦੀ ਹੋ ਸਕੇ ਜਾਂ ਗਰੀਬਾਂ ਦਾ ਭਲਾ ਕਰਨਾ ਕਿਉਂਕਿ ਸਾਨੂੰ ਹਮੇਸ਼ਾਂ ਇਮਾਨਦਾਰੀ ਦਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਬੇਈਮਾਨੀ ਦੇ ਵਿੱਚ ਕੁਝ ਵੀ ਨਹੀਂ ਰੱਖਿਆ